ਸਤਿ ਸ਼੍ਰੀ ਅਕਾਲ ਮੈਂ ਤਜਿੰਦਰ ਸਿੰਘ ਬੋਲਦਾ ਪਿਆ ਕੀ ਤੁਸੀਂ ਕਿੰਗ ਜਮੀਲ ਰੈਸਟੋਰੈਂਟ ਤੋਂ ਗੱਲ ਕਰਦੇ ਪਏ ਹੋ ਹਾਂਜੀ ਮੈਂ ਤੁਹਾਡੇ ਕੋਲੋਂ ਕੁਝ ਆਡਰ ਬੁੱਕ ਕਰਵਾਉਣਾ ਚਾਹੁੰਦਾ ਹਾਂ ਜਿਵੇਂ ਦਾਲ ਮੱਖਣੀ ਸ਼ਾਹੀ ਪਨੀਰ ਅਤੇ ਰੋਟੀਆਂ ਅਤੇ ਇੱਕ ਚੀਜ਼ ਪੀਜ਼ਾ ਬੁੱਕ ਕਰਵਾਉਣਾ ਚਾਹੁੰਦਾ ਹਾਂ ਮੈਂ ਤੁਹਾਡੇ ਕੋਲੋਂ ਅੱਗੇ ਵੀ ਬਹੁਤ ਵਾਰ ਆਡਰ ਮੰਗਵਾ ਚੁੱਕਾ ਹਾਂ ਤੁਹਾਡਾ ਖਾਣਾ ਬਹੁਤ ਹੀ ਸਵਾਦਿਸ਼ਟ ਅਤੇ ਛੇਤੀ ਡਾਈਜੈਸਟ ਹੋਣ ਵਾਲਾ ਹੈ ਬਾਜ਼ਾਰ ਨਾਲੋਂ ਸਭ ਤੋਂ ਵਧੀਆ ਖਾਣਾ ਤੁਹਾਡੇ ਕੋਲੋਂ ਹੀ ਮਿਲਦਾ ਹੈ ਜੋ ਸਾਡੇ ਰਿਲੇਟਿਵਸ ਕੈਨੇਡਾ ਤੋਂ ਆ ਰਹੇ ਹਨ ਮੈਂ ਉਹਨਾਂ ਵਾਸਤੇ ਇਹ ਆਡਰ ਬੁੱਕ ਕਰਵਾਉਣਾ ਚਾਹੁੰਦਾ ਹਾਂ ਮੈਨੂੰ ਆਸ ਹੈ ਕਿ ਤੁਸੀਂ ਪਹਿਲਾਂ ਵਾਂਗ ਹੀ ਇਹ ਆਡਰ ਵੀ ਬਹੁਤ ਵਧੀਆ ਮੈਨੂੰ ਵਧੀਆ ਖਾਣੇ ਦੇ ਸਵਾਦਿਸ਼ਟ ਅਤੇ ਛੇਤੀ ਡਾਈਜੈਸਟ ਹੋਣ ਅਤੇ ਘੱਟ ਮਸਾਲੇ ਵਾਲੇ ਹੋਣਗੇ ਇਹ ਤੁਹਾਡੇ ਕੋਲੋਂ ਮੈਂ ਆਸ ਕਰਦਾ ਹਾਂ ਅਤੇ ਮੈਂ ਫਿਰ ਬੇਨਤੀ ਕਰਦਾ ਹਾਂ ਕਿ ਮੈਨੂੰ ਆਡਰ ਦੇ ਵਿੱਚ ਦੋ ਪਲੇਟ ਦਾਲ ਮੱਖਣੀ ਦੋ ਪਲੇਟ ਸ਼ਾਹੀ ਪਨੀਰ ਅਤੇ ਰੋਟੀਆਂ ਅਤੇ ਨਾਲ ਹੀ ਦੋ ਫੁੱਲ ਲਾਰਜ ਚੀਜ਼ ਵਾਲੇ ਪੀਜੇ ਬੁੱਕ ਕੀਤੇ ਜਾਣ ਮੈਂ ਆਪ ਜੀ ਦਾ ਬਹੁਤ ਹੀ ਧੰਨਵਾਦ ਹੋਵਾਂਗਾ ਅਤੇ ਇਹ ਜਲਦੀ ਤੋਂ ਜਲਦੀ ਮੇਰੇ ਘਰ ਵਿਖੇ ਪਹੁੰਚਾਉਣ ਦੀ ਕਿਰਪਾਲਤਾ ਕਰਨ ਅਤੇ ਮੈਂ ਬੇਨਤੀ ਕਰਦਾ ਹਾਂ ਕਿ ਇਹ ਆਡਰ ਤੁਸੀਂ ਜਲਦੀ ਹੀ ਮੇਰੇ ਕੋਲ ਪਹੁੰਚਾਉਣ ਦੀ ਕਿਰਪਾਲਤਾ ਕਰੋਗੇ ਜੀ